ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੀ ਉਮਰ ਅਠਾਰਾਂ ਸਾਲ ਹੈ ਮੈਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਕ ਸੀ ਮੈਂ ਜਦੋਂ ਵੀ ਕਿਸੇ ਕੋਲੋਂ ਗਾਣੇ ਸੁਣਦਾ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਚਾਅ ਹੁੰਦਾ ਸੀ ਕਿ ਮੈਂ ਖੁਦ ਉਹ ਗਾਣੇ ਗਾਵਾਂ ਅਤੇ ਉਹਨਾਂ ਨੂੰ ਗਾ ਕੇ ਲੋਕਾਂ ਨੂੰ ਸੁਣਾਵਾਂ ਇਸ ਕਰਕੇ ਮੈਂ ਬਹੁਤ ਸਾਰੇ ਕੰਪੀਟੀਸ਼ਨ 'ਚ ਵੀ ਲੜਿਆ ਹਾਂ ਜਿੱਥੋਂ ਕਿ ਮੈਂ ਕਈ ਵਾਰੀ ਵਿਜੇਤਾ ਵੀ ਰਿਹਾ ਹਾਂ ਮੈਂ ਆਪਣੇ ਸਕੂਲ 'ਚ ਵੀ ਜਦੋਂ ਵੀ ਜਾਂਦਾ ਹਾਂ ਅਤੇ ਉਹਨਾਂ ਨੂੰ ਕਹਿੰਦਾ ਹਾਂ ਕਿ ਮੇਰੇ ਕੋਲੋਂ ਗਾਣੇ ਸੁਣੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ ਜਿੱਦਾਂ ਮੈਂ ਆਪਣੀ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਦਰਸਾਉਂਦਾ ਸੀ ਮੈਨੂੰ ਬਹੁਤ ਤਰੀਕੇ ਦੇ ਗਾਣੇ ਪਸੰਦ ਹੈ ਮੈਨੂੰ ਹਿੰਦੁਸਤਾਨੀ ਹੋ ਗਏ ਹਿੰਦੀ ਗਾਣੇ ਪੰਜਾਬੀ ਗਾਣੇ ਵਿਲਾਇਤੀ ਗਾਣੇ ਅੰਗਰੇਜ਼ੀ ਵਗੈਰਾ ਸਾਰੇ ਗਾਣੇ ਬਹੁਤ ਪਸੰਦ ਹੈ ਪਰ ਜੋ ਗਾਣੇ ਪੰਜਾਬੀ ਅਤੇ ਹਿੰਦੀ ਹੁੰਦੇ ਉਹਨਾਂ ਦੀ ਭਾਵਨਾਵਾਂ ਬਹੁਤ ਅੱਛੇ ਤਰੀਕੇ ਨਾਲ ਬੰਦੇ ਨੂੰ ਮਹਿਸੂਸ ਹੁੰਦੀਆਂ ਹਨ ਕਿਉਂਕਿ ਪੰਜਾਬੀ ਸਾਡੀ ਮਾਂ ਭਾਸ਼ਾ ਹੈ ਇਸ ਕਰਕੇ ਮੈਂ ਵੋ ਹਜੇ ਵੀ ਗਾਉਂਦਾ ਹਾਂ ਅਤੇ ਲੋਕਾਂ ਨੂੰ ਵੀ ਆਪਣੇ ਗਾਣੇ ਸੁਣਾਉਂਦਾ ਹਾਂ